ਕਹਾਣੀ ਬਹੁਤ ਪੁਰਾਣੀ ਹੈ ਜਦੋਂ ਮੈਂ ਛੋਟਾ ਸੀ ਉਦੋਂ ਮੈਂ ਇੱਕ ਫੰਕਸ਼ਨ ਤੇ ਗਿਆ ਸੀ ਜਿਸ ਵਿੱਚ ਕਿਸੇ ਫੰਕਸ਼ਨ ਵਾਲਿਆਂ ਨੇ ਪੰਮੀ ਬਾਈ ਜੋ ਕੀ ਭੰਗੜੇ ਦੇ ਮਾਹਿਰ ਸਨ ਉਹਨਾਂ ਨੂੰ ਸੱਦਿਆਂ ਹੋਇਆ ਸੀ ਪੰਮੀ ਬਾਈ ਦਾ ਭੰਗੜਾ ਦੇਖ ਕੇ ਸਾਰੇ ਹੀ ਜਿੰਨੇ ਵੀ ਯਾਦ ਗੈਸਟ ਸੀ ਸਾਰੇ ਹੀ ਨਾਲ ਨਾਲ ਭੰਗੜਾ ਪਾਣ ਲੱਗ ਪਏ ਉਹਨਾਂ ਉਹਨਾਂ ਦੇ ਭੰਗੜੇ ਦੇ ਦੇ ਤਾਲ ਦੇ ਤਾਲ ਨਾਲ ਤਬਲੇ ਆਪਣੇ ਦੇ ਢੋਲ ਦੇ ਤਾਲ ਦੇ ਨਾਲ ਪੂਰੇ ਤਾਲ ਮੈਚ ਕਰਦੇ ਸੀਗੇ ਉਹਨਾਂ ਦਾ ਭੰਗੜਾ ਦੇਖ ਕੇ ਸਾਰੀ ਸਾਰੀ ਹੀ ਯਾਦਗਾਰ ਜਿੰਨੇ ਵੀ ਗੈਸਟ ਆਏ ਸੀ ਸਾਰੇ ਖੁਸ਼ ਹੋਗੇ